ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ ਕੋਲ ਬੁਣਾਈ ਨਾਲ ਸਬੰਧਿਤ ਕਈ ਟੀਚੇ ਜਾਂ ਇੱਛਾਵਾਂ ਹਨ ਜਿਨ੍ਹਾਂ ਦੇ ਉੱਪਰ ਮੈਂ ਕਈ ਵੀ ਕੰਮ ਕਰ ਰਹੀ ਹਾਂ ਜਿਵੇਂ ਕਿ ਮੈਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਹਾਂ ਮੈਂ ਆਪਣੀ ਗ੍ਰਹਿਸਥੀ ਵਾਲੀ ਔਰਤ ਹਾਂ ਜਦੋਂ ਮੇਰਾ ਕੰਮ ਹੋ ਜਾਂਦਾ ਹੈ ਤਾਂ ਮੈਂ ਆਪਣੇ ਵਿਹਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਵਾਸਤੇ ਸਵੈਟਰ ਜੁਰਾਬਾਂ ਟੋਪੀ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾ ਲੈਂਦੀ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਬੁਣਾਈ ਵਾਲੇ ਕੱਪੜਿਆਂ ਦੇ ਵਿੱਚ ਜ਼ਿਆਦਾ ਨਿੱਘ ਹੁੰਦਾ ਹੈ ਅਤੇ ਬੁਣਾਈ ਵਾਲੇ ਕੱਪੜੇ ਆਪਾਂ ਵਰਧਮਾਨ ਉੱਨ ਹੋ ਉੱਨ ਤੋਂ ਹੋ ਹੋ ਗਏ ਇਹਨਾਂ ਨਾਲ ਬਣਾ ਸਕਦੇ ਹਾਂ ਅਤੇ ਉਹ ਕੱਪੜੇ ਥੋੜ੍ਹੇ ਫਿਟਿੰਗ ਵਾਲੇ ਵੀ ਬਣ ਜਾਂਦੇ ਹਨ ਅਤੇ ਅਸੀਂ ਆਪਣੀ ਮਰਜ਼ੀ ਅਨੁਸਾਰ ਵੀ ਬਣਾ ਸਕਦੇ ਹਾਂ ਜੇਕਰ ਉਹ ਹੀ ਆਪਾਂ ਬਾਹਰੋਂ ਲੈਣ ਜਾਈਏ ਤਾਂ ਬੜੇ ਹੀ ਜ਼ਿਆਦਾ ਮਹਿੰਗੀ ਆਉਂਦੀਆਂ ਹਨ ਅਤੇ ਜੇ ਆਪਾਂ ਘਰ ਵਿੱਚ ਉਸ ਨੂੰ ਬੁਣਾਈ ਨਾਲ ਬਣਾਈਏ ਤਾਂ ਸਿਰਫ਼ ਉੱਨ ਦੇ ਹੀ ਪੈਸੇ ਲੱਗਦੇ ਹਨ ਬਾਕੀ ਅਸੀਂ ਆਪਣੀ ਮਿਹਨਤ ਨਾਲ ਬਣਾ ਲੈਂਦੇ ਹਾਂ ਅਤੇ ਸਾਡਾ ਸਾਡਾ ਜਿਹੜਾ ਵਿਹਲਾ ਸਮਾਂ ਵੀ ਆਹ ਆਹ ਉਹ ਵੀ ਕੰਮ ਵਿੱਚ ਨਿਕਲ ਜਾਂਦਾ ਹੈ ਤਾਂ ਤਾਂ ਅਸੀਂ ਵੀ ਬੋਰ ਨਹੀਂ ਹੁੰਦੇ ਇਸ ਤਰ੍ਹਾਂ ਜਦੋਂ ਅਸੀਂ ਬੁਣਾਈ ਕਰਦੇ ਹਾਂ ਤਾਂ ਸਾਡਾ ਹੱਥ ਵੀ ਸਾਫ਼ ਹੁੰਦਾ ਹੈ ਸਾਨੂੰ ਕਈ ਪ੍ਰਕਾਰ ਦੇ ਡਿਜ਼ਾਈਨ ਵੀ ਆ ਜਾਂਦੇ ਹਨ ਜਿੱਦਾਂ ਮੈਂ ਸ਼ੁਰੂਆਤ ਸਿੱਧੇ ਪੁੱਠੇ ਦੀ ਕੀਤੀ ਸੀਗੀ ਅਤੇ ਹੌਲੀ ਹੌਲੀ ਹੁਣ ਮੈਨੂੰ ਕਈ ਪ੍ਰਕਾਰ ਦੇ ਡਿਜ਼ਾਈਨ ਵੀ ਆ ਗਏ ਅਤੇ ਮੇਰੇ ਬੱਚੇ ਵੀ ਬੜੇ ਖੁਸ਼ ਹੋ ਕੇ ਪਾਉਂਦੇ ਹਨ ਮੇਰੇ ਹੱਥ ਦੇ ਕੱਪੜੇ ਪਾ ਕੇ ਕਿਉਂਕਿ ਜਦੋਂ ਆਪਾਂ ਆਪਣੇ ਘਰ ਵਿੱਚ ਆਪ ਹੀ ਬਣਾਉਂਦੇ ਹਾਂ ਤਾਂ ਅਸੀਂ ਜਿੱਦਾਂ ਦੇ ਮਰਜ਼ੀ ਉਹਨਾਂ ਨੂੰ ਲੈ ਕੇ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਸਕਦੇ ਹਾਂ ਬਾਹਰੋਂ ਲੈਣ ਜਾਈਏ ਤਾਂ ਕਈ ਉੱਨਾਂ ਮਾੜੀਆਂ ਦੇ ਸਵੈਟਰ ਵੀ ਬਣਾਏ ਜਾਂਦੇ ਹਨ ਅਤੇ ਕਾਫ਼ੀ ਜ਼ਿਆਦਾ ਪੈਸੇ ਵਿੱਚ ਵੇਚੇ ਜਾਂਦੇ ਹਨ ਇਸ ਲਈ ਮੈਂ ਖੁਦ ਉੱਨ ਲੈ ਕੇ ਆਪਣੇ ਵਿਹਲੇ ਸਮੇਂ ਵਿੱਚ ਬੱਚਿਆਂ ਦੇ ਵਾਸਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਹਾਂ ਅਤੇ ਮੇਰੇ ਵੀ ਬੱਚੇ ਬੜੇ ਖੁਸ਼ੀ ਨਾਲ ਪਾਉਂਦੇ ਹਨ ਧੰਨਵਾਦ ਜੀ